ਹੈਲੋ ਸਤਿ ਸ਼੍ਰੀ ਅਕਾਲ ਜੀ ਜੀ ਤੁਸੀਂ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਬੋਲਦੇ ਹੋ ਹਾਂਜੀ ਅਸੀਂ ਨਾ ਬੀਜ ਲੈਣਾ ਸੀਗਾ ਸਬਜ਼ੀਆਂ ਦਾ ਵੀ ਤੁਸੀਂ ਸਾਨੂੰ ਮਾੜੀ ਜਿਹੀ ਅਸੀਂ ਪਹਿਲੀ ਵਾਰ ਖੇਤੀ ਕਰਨੀ ਆ ਇਹਦੇ ਬਾਰੇ ਸਾਨੂੰ ਦੱਸ ਸਕਦੇ ਹੋ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਸਰਦੀਆਂ 'ਚ ਹਾਂਜੀ ਹਾਂਜੀ ਹਾਂਜੀ ਜੀ ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਹਾਂਜੀ ਹਾਂਜੀ ਜੀ ਹਾਂਜੀ ਹਾਂਜੀ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਜੀ ਠੀਕ ਹੈ ਜੀ ਠੀਕ ਹਾਂਜੀ ਠੀਕ ਹੈ ਜੀ ਅਤੇ ਹੋਰ ਜੀ ਗਰਮੀ ਦੀਆਂ ਸਬਜ਼ੀਆਂ ਬਾਰੇ ਵੀ ਸਾਨੂੰ ਵੀ ਕਿਉਂਕਿ ਹੁਣ ਤਾਂ ਸਰਦੀ ਚੱਲ ਰਹੀ ਹੈ ਨਾ ਅਤੇ ਫਿਰ ਵੀ ਅਸੀਂ ਅੱਗੇ ਤੋਂ ਵੀ ਅਸੀਂ ਜਿਵੇਂ ਅਗਾਹਾਂ ਨੂੰ ਖੇਤੀ ਕਰਨੀ ਹੈ ਫਿਰ ਵੀ ਤੁਹਾਡੇ ਤੋਂ ਹੀ ਬੀਜ ਲਵਾਂਗੇ ਅਤੇ ਤੁਸੀਂ ਸਾਨੂੰ ਮਾੜਾ ਜਿਹਾ ਵੀ ਗਰਮੀ ਦੀਆਂ ਸਬਜ਼ੀਆਂ ਦੇ ਬੀਜਾਂ ਬਾਰੇ ਵੀ ਦੱਸ ਦਿਓ ਹਾਂਜੀ ਹਾਂਜੀ ਹਾਂਜੀ ਜੀ ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਹਾਂਜੀ ਜੀ ਠੀਕ ਹੈ ਜੀ ਹਾਂਜੀ ਜੀ ਹਾਂਜੀ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਜੀ

ਠੀਕ ਹੈ ਜੀ ਠੀਕ ਹੈ ਹਾਂਜੀ ਸਾਨੂੰ ਥੋੜ੍ਹੀ ਜਿਹੀ ਹੋਰ ਜਾਣਕਾਰੀ ਦਿਓ ਜੀ ਇਹਨਾਂ ਸਬਜ਼ੀਆਂ ਹਾਂਜੀ ਹਾਂਜੀ ਹਾਂਜੀ ਸਾਰਾ ਸੰਭਾਲਣ ਵਾਸਤੇ ਹਾਂਜੀ ਹਾਂਜੀ ਹਾਂਜੀ ਹਾਂਜੀ ਜੀ ਹਾਂਜੀ ਜੀ ਠੀਕ ਹੈ ਜੀ ਹਾਂਜੀ ਜੀ ਹਾਂਜੀ ਠੀਕ ਹੈ ਜੀ ਹਾਂਜੀ ਜੀ

ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਸਤਿ ਸ਼੍ਰੀ ਅਕਾਲ ਜੀ